ਹਾਂਜੀ ਮੇਰੇ ਕੋਲ ਘਰ ਵਿੱਚ ਦਰੱਖਤ ਲੱਗੇ ਹੋਏ ਹਨ ਵਿਹੜੇ ਦੇ ਵਿੱਚ ਜਿਨ੍ਹਾਂ 'ਤੇ ਪੰਛੀ ਅਕਸਰ ਆ ਕੇ ਬੈਠਦੇ ਹਨ ਅਤੇ ਮੈਂ ਪੰਛੀਆਂ ਨੂੰ ਫਿਰ ਦੇਖਦਾ ਰਹਿੰਦਾ ਹਾਂ ਅਤੇ ਮੇਰੇ ਘਰ ਵਿੱਚ ਵਿਹੜੇ ਦੇ ਵਿੱਚ ਇੱਕ ਅਮਰੂਦ ਦਾ ਦਰੱਖਤ ਲੱਗਿਆ ਹੋਇਆ ਹੈ ਜਿਸ 'ਤੇ ਆ ਕੇ ਸਾਰੇ ਹੀ ਪੰਛੀ ਬੈਠ ਕੇ ਆਪਣੀ ਆਵਾਜ਼ਾਂ ਸੁਣਾਉਂਦੇ ਨੇ ਮੈਨੂੰ ਅਤੇ ਬਾਕੀ ਪੰਛੀਆਂ ਨੂੰ ਆਕਰਸ਼ਿਤ ਕਰਨ ਲਈ ਮੈਂ ਛੱਤ 'ਤੇ ਵੀ ਪ ਪਾਣੀ ਅਤੇ ਅਨਾਜ ਰੱਖਦਾ ਹੈ ਜਿਵੇਂ ਚੌਲ ਕਣਕ ਅਤੇ ਜਿਹਨੂੰ ਖਾਣ ਫਿਰ ਛੱਤ 'ਤੇ ਪ ਸਾਰੇ ਪੰਛੀ ਆਉਂਦੇ ਨੇ ਜ਼ਿਆਦਾਤਰ ਕਬੂਤਰ ਆਉਂਦੇ ਨੇ ਕਬੂਤਰ ਫਿਰ ਕ ਇਕੱਠੇ ਹੋ ਕੇ ਖਾਂਦੇ ਨੇ ਚੌਲ ਅਤੇ ਕਣਕ ਅਤੇ ਉਤੋਂ ਬਾਅਦ ਚਿੜੀਆਂ ਵੀ ਆ ਜਾਂਦੀਆਂ ਨੇ ਕਾਂ ਫਿਰ ਪਾਣੀ ਵੀ ਰੱਖ ਹੁੰਦਾ ਪਾਣੀ ਵੀ ਸਾਰੇ ਅਕਸਰ ਪੀ ਕੇ ਹੀ ਜਾਂਦੇ ਨੇ ਪੰਛੀ ਮੈਂ ਜਦੋਂ ਵੀ ਛੱਤ 'ਤੇ ਚੜਦਾ ਉਦੋਂ ਪੰਛੀ ਹੁੰਦੇ ਹੀ ਹੁੰਦੇ ਨੇ ਛੱਤ 'ਤੇ ਬੈਠੇ ਅਨਾਜ ਖਾ ਰਹੇ ਹੁੰਦੇ ਨੇ ਕੁਝ ਕੁ ਕੁਝ ਕੁ ਪਾਣੀ ਪੀ ਰਹੇ ਹੁੰਦੇ ਨੇ ਅਤੇ ਬਾਕੀ ਜਿਹੜੇ ਘਰ 'ਚ ਦਰੱਖਤ ਲੱਗੇ ਹੋਏ ਨੇ ਉਹਨਾਂ 'ਤੇ ਤਾਂ ਬੈਠੇ ਹੀ ਰਹਿੰਦੇ ਨੇ ਪੰਛੀ ਉਸ 'ਤੇ ਕੁਝ ਪੰਛੀਆਂ ਨੇ ਆਪਣਾ ਘਰ ਵੀ ਬਣਾਇਆ ਆਲ੍ਹਣੇ ਪਾਏ ਹੋਏ ਨੇ ਅਤੇ ਉਹ ਸਾਰਾ ਦਿਨ ਉੱਥੇ ਹੀ ਹੁੰਦੇ ਨੇ ਬੈਠੇ ਦਰੱਖਤ 'ਤੇ